ਜੇਕਰ ਪੰਜਾਬ ਦੇ ਕੁਝ ਮਹੱਤਵਪੂਰਨ ਨਿਸ਼ਾਨਾਂ ਅਤੇ ਸਮਾਰਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਮ ਤਾਂ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਦਾ ਆਉਂਦਾ ਹੈ ਜੋ ਸ਼੍ਰੀ ਗੁਰੂ ਜੀ ਦੁਆਰਾ ਬਣਾਇਆ ਗਿਆ ਸੀ ਇਹ ਇਸ ਨੂੰ ਗੋਲਡਨ ਟੈਂਪਲ ਜਾਂ ਹਰਿਮੰਦਰ ਸਾਹਿਬ ਵੀ ਆਖਿਆ ਜਾਂਦਾ ਹੈ ਜੋ ਕਿ ਸੋਨੇ ਨਾਲ ਜੜਿਆ ਹੋਇਆ ਆਪਣਾ ਇੱਕ ਮਹੱਤਵਪੂਰਨ ਗੁਰਦੁਆਰਾ ਸਾਹਿਬ ਹੈ ਅਤੇ ਆਪਾਂ ਹੋਰ ਵੀ ਗੱਲ ਕਰੀਏ ਤਾਂ ਕਿਲ੍ਹਾ ਮੁਬਾਰਕ ਬਠਿੰਡੇ ਦਾ ਇੱਕ ਬਹੁਤ ਵਧੀਆ ਸਮਾਰਕ ਹੈ ਜਿ ਜਿਸ ਨੂੰ ਦੇਖਣ ਲਈ ਲੋਕ ਦੂਰ ਦੂਰੋਂ ਆਉਂਦੇ ਹਨ ਅਤੇ ਆਪਾਂ ਹੋਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਰਣਜੀਤ ਸਿੰਘ ਵਾਰ ਮੇਮੋਰਿਅਲ ਅਤੇ ਲੋਧੀ ਫੋਰਟ ਵੀ ਹੈਗੇ ਆ ਜੋ ਕਿ ਆਪਣੇ ਇਤਿਹਾਸ ਨੂੰ ਵਿਖਾਉਂਦੇ ਹਨ ਜੇ ਪੰਜਾਬ ਦੇ ਵਿੱਚ ਹੋਰ ਗੱਲ ਕਰੀਏ ਤਾਂ ਪਟਿਆਲੇ ਦੇ ਸ਼ੀਸ਼ ਮਹਿਲ ਕਾਲੀ ਮਾਤਾ ਮੰਦਰ ਪਟਿਆਲਾ ਅਤੇ ਹੋਰ ਮਾਨਸਾ ਮਾਤਾ ਦੇਵੀ ਮੰਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਆਪਣੀ ਪੁਰਾਣੀ ਇਤਿਹਾਸ ਨੂੰ ਵਿਖਾਉਂਦੇ ਹੋਏ ਪੰਜਾਬ ਦੀ ਸ਼ੋਭਾ ਬੜ੍ਹਾਉਂਦੇ ਨੇ ਅਤੇ ਇਹਨਾਂ ਨੂੰ ਵੇਖਣ ਲਈ ਦੂਰ ਦੂਰ ਤੋਂ ਲੋਕ ਪੰਜਾਬ ਘੁੰਮਣ ਆਉਂਦੇ ਹਨ ਜੋ ਕਿ ਪੰਜਾਬ ਦੀ ਇਕੋਨਮੀ ਲਈ ਵੀ ਬਹੁਤ ਵੱਡੀ ਅਤੇ ਬਹੁਤ ਵਧੀਆ ਗੱਲ ਹੈ